ਅਸੀਂ ਇੱਕ ਵਾਰੀ ਯਾਰਾਂ ਦੋਸਤਾਂ ਦੇ ਨਾਲ ਸਲਾਹ ਕੀਤੀ ਕਿ ਇ ਮੌ ਟਾਇਮ ਵਿਹਲਾ ਹੈ ਆਪਾਂ ਕਿਸੇ ਗੁਰੂ ਘਰ ਦੇ ਅਸਥਾਨ ਦੇ ਦਰਸ਼ਨ ਕਰੀਏ ਤੋਂ ਮੇਰੇ ਦੋਸਤਾਂ ਨੇ ਜੋ ਕਿ ਪ੍ਰਿੰਸੀਪਲ ਹਨ ਇਸ ਟਾਇਮ ਉਹ ਰਿਟਾਇਰ ਹੋਏ ਹਨ ਉਨ੍ਹਾਂ ਨੇ ਆਖਿਆ ਵੀ ਅਸੀਂ ਨੇੜੇ ਦੇ ਗੁਰੂ ਦਰਬਾਰ ਸਾਹਿਬ ਸਾਰੇ ਦੇਖੇ ਹਨ ਕਿ ਇੱਕ ਗੁਰੂ ਅਸਥਾਨ ਗੁਰਦੁਆਰਾ ਸ੍ਰੀ ਧੂਬਰੀ ਸਾਹਿਬ ਜੋ ਕਿ ਅਸਾਮ ਦੇ ਵਿੱਚ ਪੈਂਦਾ ਹੈ ਉੱਥੇ ਦੀ ਯਾਤਰਾ ਆਪਾਂ ਨੇ ਜ਼ਰੂਰ ਕਰਨੀ ਹੈ ਅਸੀਂ ਆਪਣੀ ਟਰੇਨ ਦੇ ਵਿੱਚ ਟਿਕਟਾਂ ਬੁੱਕ ਕਰਾ ਕੇ ਟਰੇਨ ਰਾਹੀਂ ਪਹੁੰਚੇ ਉੱਥੇ ਸਾਡੇ ਉਸ ਪਹਿਲਾਂ ਰਿਸ਼ਤੇਦਾਰ ਸੰਬੰਧੀ ਪੁਰਾਣੇ ਸਨ ਅਸੀਂ ਇਸ ਕਰਕੇ ਉੱਥੇ ਪਹੁੰਚੇ ਪਹੁੰਚ ਕੇ ਉਨ੍ਹਾਂ ਦੇ ਨਾਲ ਉਹ ਸਾਨੂੰ ਆਪਣੇ ਨਾਲ ਲੈ ਕੇ ਧੂਬਰੀ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਾਏ ਅਤੇ ਦੇਖ ਕੇ ਬੜੀ ਰੂਹ ਖੁਸ਼ ਹੋਈ ਜੋ ਕਿ ਉਸ ਲੋਕਾਂ ਨੇ ਗੁਰੂ ਤੇਗ ਤੇਗ ਬਹਾਦਰ ਸਾਹਿਬ ਨਾਲ ਧੋਖਾਬਾਜ਼ੀ ਧੜੀ ਕੀਤੀ ਸੀਗੀ ਉਸ ਤੋਂ ਉਨ੍ਹਾਂ ਨੇ ਉਸ ਸਥਾਨ ਨੂੰ ਛੱਡ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਹਨ ਕਿ ਸਾਡਾ ਆਪਣੇ ਰਿਸ਼ਤੇਦਾਰਾਂ ਦੇ ਘਰ ਵੀ ਜਾਣ ਨੂੰ ਨਹੀਂ ਦਿਲ ਕੀਤਾ ਕਿ ਅਸੀਂ ਐਡੀ ਦੂਰੋਂ ਆਏ ਹਾਂ ਅਸਾਮ ਦੇ ਵਿੱਚ ਅਸੀਂ ਗੁਰੂ ਘਰ ਦੇ ਵਿੱਚ ਆਪਣਾ ਟਾਇਮ ਲੰਘਾਇਆ ਗਿਆ ਹੈ ਅਤੇ ਗੁਰੂ ਘਰ ਦੇ ਦਰਸ਼ਨ ਕੀਤੇ ਹਨ ਸਾਨੂੰ ਗੁਰਦੁਆਰਾ ਘਰ ਘਰ ਤੋਂ ਬਾਹਰ ਜਾਣ ਨੂੰ ਵੀ ਨਹੀਂ ਜੀ ਕੀਤਾ ਅਤੇ ਬਾਣੀ ਸੁਣੀ ਅਤੇ ਹੋਰ ਗੁਰੂ ਮਹਾਰਾਜ ਦੀਆਂ ਕਹਾਣੀਆਂ ਸੁਣੀਆਂ ਉਸ ਤੋਂ ਬਾਅਦ ਅਸੀਂ ਅਤੇ ਇੱਕ ਹਫਤਾ ਗੁਜਾਰ ਕੇ ਘੁੰਮ ਫਿਰ ਦੇ ਆਪਣੇ ਟਰੇਨ ਦੇ ਰਾਹੀਂ ਆਪਣੇ ਪ ਦੋਸਤਾਂ ਦੇ ਨਾਲ ਆਪਣੇ ਪੰਜਾਬ ਦੇ ਵਿੱਚ ਪਹੁੰਚ ਗਏ ਹਨ